ਹਾਂਜੀ ਓਲਾ ਕਾਰ ਟਰੈਵਲ ਏਜੰਸੀ ਅਸੀਂ ਇੱਕ ਸ਼ਿਕਾਇਤ ਦਰਜ ਕਰਨੀ ਸੀ ਕਿ ਤੁਹਾਡੀ ਏਜੰਸੀ ਦੇ ਵਿੱਚੋਂ ਇੱਕ ਡਰਾਈਵਰ ਨੂੰ ਅਸੀਂ ਬੁੱਕ ਕੀਤਾ ਸੀਗਾ ਸ਼੍ਰੀਨਗਰ ਦੀ ਬੁਕਿੰਗ ਲਈ ਸੀ ਉਹਨੇ ਅਸੀਂ ਪੰਜ ਸਵਾਰੀਆਂ ਸੀਗੀਆਂ ਅਤੇ ਉਹਨਾਂ ਨੇ ਪਹਿਲਾਂ ਪੇਮੈਂਟ ਲੈ ਲਈ ਸੀਗੀ ਸਾਡੇ ਤੋਂ ਹਾਫ ਪੇਮੈਂਟ ਅਤੇ ਹੁਣ ਅਸੀਂ ਕਦੋਂ ਦੇ ਉਹਨੂੰ ਫ਼ੋਨ ਕਰ ਰਹੇ ਹਾਂ ਪਰ ਉਹ ਸਾਡਾ ਫ਼ੋਨ ਨਹੀਂ ਚੁੱਕ ਰਿਹਾ ਹੈਗਾ ਪਲੀਜ਼ ਜਲਦੀ ਤੋਂ ਜਲਦੀ ਉਸ ਡਰਾਈਵਰ ਦੇ ਨਾਲ ਕੰਟੈਕਟ ਕਰੋ ਅਸੀਂ ਉਸਦਾ ਨੰਬਰ ਵੀ ਤੁਹਾਨੂੰ ਭੇਜ ਦਿੰਦੇ ਹਾਂ ਸਾਡੇ ਅੱਧੇ ਦੋਸਤ ਜਿਹੜੇ ਨੇ ਸਾਡਾ ਕਦੋਂ ਦਾ ਵੇਟ ਕਰ ਰਹੇ ਨੇ ਉਹ ਅੱਧੇ ਰਸਤੇ ਦੇ ਉੱਤੇ ਉਹ ਪਹੁੰਚੇ ਹੋਏ ਨੇ ਪਰ ਅਸੀਂ ਇਸ ਕਾਰਨ ਕਰਕੇ ਪਹੁੰਚ ਨਹੀਂ ਪਾ ਰਹੇ ਹੈਗੇ ਸਾਡੇ ਅਸੀਂ ਬਹੁਤ ਸਾਰੀਆਂ ਸੋਚਿਆ ਸੀਗਾ ਕਿ ਅਸੀਂ ਇੱਥੇ ਘੁੰਮਾਂਗੇ ਡਰਾਈਵਰ ਨਾਲ ਸਾਡੀ ਗੱਲ ਹੋਈ ਸੀ ਉਦੋਂ ਉਹ ਕਹਿੰਦਾ ਸੀਗਾ ਪਹਿਲਾਂ ਤੁਹਾਨੂੰ ਡਲ ਲੇਕ 'ਤੇ ਲੈ ਕੇ ਜਾਵਾਂਗੇ ਅਤੇ ਫਿਰ ਬਾਅਦ ਚੋਂ ਗੁਲਮਾਰਗ ਅਤੇ ਸੋਨ ਮਾਰਗ ਅਤੇ ਫਿਰ ਬਾਅਦ ਚੋਂ ਜਿਹੜਾ ਫੁਹਾਰਾ ਪਾਰਕ ਹੈ ਉੱਥੇ ਵੀ ਲੈ ਕੇ ਜਾਵੇਗਾ ਪਰ ਸਾਡੀਆਂ ਸਾਰੀਆਂ ਜਿਹੜੇ ਸੀਗੇ ਸੋਚਾਂ ਸੀਗੀਆਂ ਸਾਰੀਆਂ 'ਤੇ ਪਾਣੀ ਫਿਰ ਗਿਆ ਆ ਪਰ ਪਲੀਜ਼ ਜਲਦੀ ਤੋਂ ਜਲਦੀ ਸਾਨੂੰ ਕੋਈ ਹੋਰ ਕੈਬ ਬੁੱਕ ਕਰਕੇ ਦੇਵੋ ਔਰ ਪਰ ਅਸੀਂ ਉਸ ਨੂੰ ਦੇਵਾਂਗੇ ਹਾਫ ਪੇਮੈਂਟ ਹੀ ਕਿਉਂਕਿ ਸਾਡੇ ਤੋਂ ਹਾਫ ਪੇਮੈਂਟ ਪਹਿਲਾਂ ਹੀ ਉਹ ਡਰਾਈਵਰ ਨੇ ਲੈ ਚੁੱਕਿਆ ਹੈ ਸੋ ਜਲਦੀ ਤੋਂ ਜਲਦੀ ਤੁਸੀਂ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰੋ ਕਿ ਕਿੱਥੇ ਹੈ ਉਹ ਕਿਉਂ ਨਹੀਂ ਫ਼ੋਨ ਚੁੱਕ ਰਿਹਾ ਹੈਗਾ